ਭਾਰਤ ਦਾ ਭੋਜਨ ਬਹੁਤ ਹੀ ਸੰਤੁਲਿਤ ਭੋਜਨ ਹੈ ਬਹੁਤ ਹੀ ਸਿਹਤ ਵਰਧਕ ਭੋਜਨ ਹੈ ਔਰ ਇਸ ਵਿੱਚ ਜਿਹੜੇ ਅਲੱਗ ਅਲੱਗ ਬਹੁਤ ਰਾਜ ਨੇ ਭਾਰਤ ਵਿੱਚ ਹਰੇਕ ਰਾਜ ਦੀ ਜਿਹੜਾ ਭੋਜਨ ਹੈ ਆਪੋ ਆਪਣੀ ਜਿਹੜੀ ਉਹਨਾਂ ਦੀ ਸੱਭਿਅਤਾ ਅਤੇ ਜਾਂ ਉਹਨਾਂ ਦੇ ਰਹਿਣ ਸਹਿਣ ਦੇ ਅਨੁਸਾਰ ਜਾਂ ਉਹਨਾਂ ਦੇ ਮੌਸ ਮੌਸਮ ਦੇ ਹਿਸਾਬ ਨਾਲ਼ ਉਹ ਜਿਹੜਾ ਉੱਥੇ ਬਣਾਇਆ ਜਾਂਦਾ ਏ ਔਰ ਖਾਇਆ ਜਾਂਦਾ ਏ ਅਤੇ ਭਾਰਤ ਦੇ ਸਾਰੇ ਹੀ ਰਾਜਾਂ ਵਿੱਚੋਂ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰਸਿੱਧ ਪਕਵਾਨ ਹੈ ਜਿਵੇਂ ਸਾਊਥ ਵਾਲੀ ਸਾਈਡ ਅਗਰ ਗੱਲ ਕਰੀਏ ਤਾਂ ਉੱਧਰ ਆਪਣਾ ਹੈ ਡੋਸਾ ਇਡਲੀ ਸਾਂਬਰ ਵੜਾ ਦਹੀਂ ਭੱਲੇ ਇਹ ਚੀਜ਼ਾਂ ਜਿਹੜੀਆਂ ਉੱਧਰ ਦੇ ਪ੍ਰਸਿੱਧ ਪਕਵਾਨ ਹੈ ਇੱਧਰ ਆਪਣਾ ਚਲੇ ਜ ਤਾਮਿਲ ਸਾਈਡ ਜਿਹੜਾ ਹੈ ਇਹ ਕਰਦੇ ਹੈ ਆਪਣਾ ਚਾਵਲ ਔਰ ਦਾਲ ਬਾਟੀ ਚੂਰਮਾ ਅਤੇ ਆਪਣਾ ਪੰਜਾਬ ਵੱਲ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆ ਜਾਂਦਾ ਏ ਛੋਲੇ ਭਟੂਰੇ ਅਪਣਾ ਸਾਗ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਜਾਂ ਫਿਰ ਪੰਜਾਬ ਵਿੱਚ ਤਾਂ ਕਈ ਤਰ੍ਹਾਂ ਦੇ ਭੋਜਨ ਹੈ ਅਤੇ ਸਾਰੇ ਹੀ ਜਿਹੜੇ ਬਹੁਤ ਹੀ ਮਸਾਲੇਦਾਰ ਭੋਜਨ ਹੈ ਅਤੇ ਸਾਰੇ ਹੀ ਭੋਜਨ ਹਰ ਤਰ੍ਹਾਂ ਦਾ ਪੰਜਾਬ ਦਾ ਭੋਜਨ ਪ੍ਰਸਿੱਧ ਹੀ ਹੈ ਆਪਣੇ ਆਪ ਵਿੱਚ ਔਰ ਪੰਜਾਬ ਦੇ ਵਿੱਚ ਵ ਸਾਰੇ ਹੀ ਭੋਜਨ ਜਿਹੜੇ ਹੈਗੇ ਉਹ ਇਕੱਲੇ ਪੰਜਾਬ ਵਿੱਚ ਨਹੀਂ ਹੈ ਪੂਰੇ ਭਾਰਤ ਵਿੱਚ ਹੀ ਪ੍ਰਸਿੱਧ ਹਨ